ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਵਿੱਚ ਰਹਿੰਦੀ ਹਾਂ ਮੈਂ ਤੁਹਾਨੂੰ ਕੁਛ ਦੱਸਣਾ ਚਾਹੁੰਦੀ ਹਾਂ ਕਿ ਮੈਂ ਥੋੜ੍ਹੇ ਹੀ ਦਿਨ ਪਹਿਲਾਂ ਕੁਛ ਖਾਣ ਵਾਸਤੇ ਮੰਗਵਾਇਆ ਸੀ ਤੁਹਾਡੀ ਕੰਪਨੀ ਤੋਂ ਜਿਸ ਵਿੱਚ ਮੈਨੂੰ ਬੜਾ ਹੀ ਚੰਗਾ ਲੱਗਿਆ ਸੀ ਮੈਂ ਦੋ ਤਿੰਨ ਵਾਰ ਸਮਾਨ ਮੰਗਵਾਇਆ ਅਤੇ ਮੈਨੂੰ ਬੜਾ ਹੀ ਚੰਗਾ ਲੱਗਿਆ ਜਿਹੜੇ ਮੈਨੂੰ ਸਮਾਨ ਦੇਣ ਆਉਂਦੇ ਸਨ ਉਹ ਉਹਨਾਂ ਦੀ ਨੇਚਰ ਬਹੁਤ ਹੀ ਅੱਛੀ ਸੀ ਕੁਛ ਹੀ ਦਿਨ ਪਹਿਲਾਂ ਮੈਂ ਕੁਛ ਹੋਰ ਵੀ ਮੰਗਵਾਉਣ ਬਾਰੇ ਸੋਚਿਆ ਤੁਹਾਡੀ ਕੰਪਨੀ ਤੋਂ ਕੁਛ ਹੋਰ ਮੰਗਵਾਉਣ ਬਾਰੇ ਸੋਚਿਆ ਅਤੇ ਜਦੋਂ ਮੈਂ ਕੁਛ ਮੰਗਵਾਉਣ ਲਈ ਤੁਹਾਡੀ ਕੰਪਨੀ ਨੂੰ ਆ ਆਰਡਰ ਕੀਤਾ ਤਾਂ ਥੋੜ੍ਹੇ ਹੀ ਦਿਨ ਬਾਅਦ ਮੇਰਾ ਕੁਛ ਸਮਾਨ ਆਇਆ ਜਦੋਂ ਮੇਰਾ ਸਮਾਨ ਆਇਆ ਤਾਂ ਜਿਹੜਾ ਇਸ ਵਾਰ ਉਹਨਾਂ ਨੇ ਕੋਈ ਭੇਜਿਆ ਉਹ ਲੜਕਾ ਬਹੁਤ ਹੀ ਗਲਤ ਸੀ ਉਸਨੇ ਮੈਨੂੰ ਬਹੁਤ ਹੀ ਬੁਰੀ ਨਜ਼ਰ ਨਾਲ ਦੇਖਿਆ ਅਤੇ ਮੈਨੂੰ ਉਸ ਦਾ ਸਮਾਨ ਵੀ ਪਸੰਦ ਨਹੀਂ ਆਇਆ ਜਦੋਂ ਉਸਨੇ ਸਮਾਨ ਦਿੱਤਾ ਤਾਂ ਉਸਦਾ ਰਵੱਈਆ ਮੇਰੇ ਨਾਲ ਬਹੁਤ ਹੀ ਗਲਤ ਵਾਪਰਿਆ ਤਾਂ ਮੈਂ ਤ ਤੁਹਾਡੀ ਕੰਪਨੀ ਨੂੰ ਇਹ ਸ਼ਿਕਾਇਤ ਕਰਦੀ ਹਾਂ ਕਿ ਜਦੋਂ ਵੀ ਕੋਈ ਅਸੀਂ ਸਮਾਨ ਮੰਗਵਾਉਂਦੇ ਹਾਂ ਤਾਂ ਤੁਹਾਡੇ ਅੱਗੇ ਇਹ ਹੀ ਬੇਨਤੀ ਹੈ ਕਿ ਤੁਸੀਂ ਕੋਈ ਚੰਗਾ ਇਨਸਾਨ ਭੇਜਿਆ ਕਰੋ